ਸ਼੍ਰੀ ਮਾਨ ਜੀ ਸਤਿ ਸ਼੍ਰੀ ਅਕਾਲ ਮੇਰੇ ਪਿਛਲੇ ਔਡਰ ਵਿੱਚੋਂ ਪੀਜ਼ਾ ਹਟਾ ਦਿੱਤਾ ਜਾਵੇ ਅਤੇ ਬਾਕੀ ਰਹਿੰਦਾ ਕੋਲਡ ਕੌਫੀ ਅਤੇ ਪਾਸਤਾ ਮੈਨੂੰ ਦੇ ਦਿੱਤਾ ਜਾਵੇ